ਮੈਂ ਆਪਣੀ ਗਾਇਕੀ ਵਿੱਚ ਗਤੀਸ਼ੀਲਤਾ ਨੂੰ ਬੋਲ ਬੋਲ ਕੇ ਬੋਲ ਕੇ ਅਭਿਆਸ ਕਰ ਕਰ ਕੇ ਉਹਨਾਂ ਦੇ ਅਭਿਆਸ ਆਪਣੇ ਦਿਨ ਚਰਿਆ ਦੇ ਵਿੱਚ ਜਦੋਂ ਮੈਂ ਵਿਹਲੀ ਹੁੰਦੀ ਹਾਂ ਮੈਂ ਉਦੋਂ ਬਹਿ ਕੇ ਆਪਣੇ ਬੋਲਾਂ ਨੂੰ ਪ੍ਰਕਿਰਤੀ ਤੋਂ ਕੁਝ ਸ਼ਬਦ ਚੱਕ ਕੇ ਨੇਚਰ ਦੇ ਵਿੱਚੋਂ ਸ਼ਬਦ ਚੱਕ ਕੇ ਪ੍ਰਕਿਰਤੀ ਦੇ ਵਿੱਚੋਂ ਅਤੇ ਉਹਨਾਂ ਨੂੰ ਆਪਣੇ ਬੋਲਾਂ ਵਿੱਚ ਸ਼ਾਮਿਲ ਕਰਦੀ ਹਾਂ ਉਸ ਤੋਂ ਬਾਅਦ ਮੈਂ ਆਪਣੇ ਬੋਲਾਂ ਨੂੰ ਲਿਖ ਕੇ ਦੇਖਦੀ ਹਾਂ ਕਿ ਉਹਨਾਂ ਵਿੱਚ ਨਵੇਂ ਨਵੇਂ ਸ਼ਬਦ ਪਾ ਕੇ ਗਾਇਕੀ ਦੇ ਨਵੇਂ ਸ਼ਬਦ ਪਾ ਕੇ ਉਹਨਾਂ ਨੂੰ ਮਤਲਬ ਸ਼ਾਮਿਲ ਕਰਦੀ ਹਾਂ ਅਤੇ ਫਿਰ ਉਹਨਾਂ ਨੂੰ ਬੋਲ ਕੇ ਗਾ ਕੇ ਚੰਗੀ ਤਰ੍ਹਾਂ ਉਹਨਾਂ ਦੀ ਵਿਆਖਿਆ ਕਰਦੀ ਹੋਈ ਉਹਨਾਂ ਨੂੰ ਦੇਖਦੀ ਹਾਂ ਉਹਦੇ ਵਿੱਚ ਨਵੇਂ ਸ਼ਬਦ ਨਵੇਂ ਬੋਲ ਰਾਗ ਧੁਨਾਂ ਨਵੀਆਂ ਸ਼ਾਮਿਲ ਕਰਕੇ ਉਹਨਾਂ ਨੂੰ ਦੇਖਦੀ ਹਾਂ ਅਤੇ ਆਪਣੇ ਬੋਲ ਬਣਾਉਂਦੀ ਹਾਂ ਆਪਣੀਆਂ ਲੰਬੀਆਂ ਲਾਈਨਾਂ ਗਾਣੇ ਦੀਆਂ ਨਵੀਆਂ ਉਹਨਾਂ ਦੀ ਵਿਆਖਿਆ ਕਰਦੀ ਹਾਂ ਬੋਲ ਕੇ ਉਹਨੂੰ ਟਾਈਮ ਦਿੰਦੀ ਹਾਂ ਰਿਆਜ਼ ਕਰਦੀ ਹਾਂ ਉਹਦੀ ਅਭਿਆਸ ਕਰਦੀ ਹਾਂ ਅਭਿਆਸ ਕਰਕੇ ਫਿਰ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਗਾ ਕੇ ਦੇਖਦੀ ਹਾਂ ਅਤੇ ਆਪਣੀ ਗਾਇਕੀ ਨੂੰ ਹੋਰ ਆਪਣੀ ਵਧੀਆ ਬਣਾਉਂਦੀ ਹਾਂ ਜਿੰਨੀ ਜ਼ਿਆਦਾ ਮੈਂ ਅਭਿਆਸ ਕਰਦੀ ਹਾਂ ਮੇਰਾ ਉਨਾ ਹੀ ਮੇਰੇ ਬੋਲਣ ਦੀ ਗਤੀਸ਼ੀਲਤਾ ਵਿੱਚ ਵਾਧਾ ਹੁੰਦਾ ਉਨਾ ਹੀ ਮੈਂ ਸੁਰ ਨਾਲ ਧੁਨਾਂ ਨਾਲ ਚੰਗੀ ਤਰ੍ਹਾਂ ਗਾ ਪਾਉਂਦੀ ਹਾਂ ਅਤੇ ਜਿਹਦੇ ਨਾਲ ਮੇਰੀ ਗਾਇਕੀ ਵਿੱਚ ਹੋਰ ਜ਼ਿਆਦਾ ਪ੍ਰਫੁਲਤਾ ਆਉਂਦੀ ਹੈ ਬਹੁਤ ਜ਼ਿਆਦਾ ਵਾਧਾ ਹੁੰਦਾ ਹੈ